ਹੈਲੋ ਹਾਂਜੀ ਮੈਮ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਹਾਂ ਹਾਂਜੀ ਮੈਮ ਹਾਂਜੀ ਕਿੰਨੇ ਜਣੇ ਹੋ ਹਾਂਜੀ ਪਹੁੰਚਾ ਦੇਵਾਂਗੇ ਜੀ ਕਿੰਨੇ ਜਣੇ ਹੋਵੋਗੇ ਤੁਸੀਂ ਠੀਕ ਹੈ ਜੀ ਚਲੇ ਜਾਏ ਚਲੇ ਜਾਵਾਂਗੇ ਜੀ ਇੱਕ ਬੰਦੇ ਦਾ ਪੰਜਾਹ ਰੁਪਏ ਕਰਾਇਆ ਨਹੀਂ ਨਹੀਂ ਮੈਮ ਇਹ ਫਿਕਸ ਹੈਗਾ ਭਾਵੇਂ ਤੁਸੀਂ ਕਿਸੇ ਹੋਰ ਤੋਂ ਵੀ ਪਤਾ ਕਰ ਲਓ ਅਤੇ ਤੁਹਾਨੂੰ ਪੂਰੀ ਸੇਫ ਰਾਈਡ ਮਿਲੇਗੀ ਹਾਂਜੀ ਜੀ ਆ ਸਕਦੇ ਹਾਂ ਤੁਸੀਂ ਆਪਣਾ ਐਡਰੈਸ ਮੈਨੂੰ ਲਿਖ ਕੇ ਵਟਸਐਪ 'ਤੇ ਭੇਜ ਦੇਣਾ ਹਾਂਜੀ ਕੋਈ ਦਿੱਕਤ ਨਹੀਂ ਲੈ ਲਾਂਗੇ ਪਰ ਉਹਨਾਂ ਨੂੰ ਟਾਈਮ ਦੱਸ ਦਿੰਨਾ ਵੀ ਉੰਨੇ ਟਾਈਮ ਤੱਕ ਆਪਾਂ ਜਾਣਾ ਕਿਉਂਕਿ ਫਿਰ ਅਸੀਂ ਨੈਕਸਟ ਕਸਟਮਰ ਵੀ ਲੈਣੇ ਹੁੰਦੇ ਹੈ ਹਾਂਜੀ ਪੂਰਾ ਸੇਫ ਹੋਵੇਗਾ ਤੁਹਾਨੂੰ ਉਹ ਹੀ ਡਰਾਈਵਰ ਅਵੇਲੇਬਲ ਕਰਵਾਵਾਂਗੇ ਜਿਹਦਾ ਪੂਰਾ ਲਾਈਸੈਂਸ ਪ੍ਰੋਪਰ ਵਹੀਕਲ ਦਾ ਪੂਰੇ ਕਾਗਜ਼ ਪੂਰੇ ਹੋਣਗੇ ਹਾਂਜੀ ਬੈਠ ਸਕਦੇ ਹੈ ਹਾਂਜੀ ਉਹ ਸਪੈਸ਼ਲ ਅਸੀਂ ਸੈਂਟਡ ਬਣਾਇਆ ਹੋਇਆ ਤੁਹਾਡਾ ਸਮਾਨ ਕੋਈ ਡਿੱਗੇਗਾ ਵੀ ਨਹੀਂ ਅਤੇ ਜੇ ਕੋਈ ਡਿੱਗ ਪੈਂਦਾ ਕੋਈ ਜਿਵੇਂ ਟੁੱਟ ਭੱਜ ਹੋ ਜਾਂਦੀ ਹੈ ਤਾਂ ਉਹਦਾ ਸਾਰਾ ਨੁਕਸਾਨ ਅਸੀਂ ਆਪ ਲਵਾਂਗੇ ਹਾਂਜੀ ਮੈੈਮ ਉਹਦੇ ਐਕਸਟਰਾ ਚਾਰਜਿਜ ਲੱਗਣਗੇ ਹਾਂਜੀ ਆਨਲਾਈਨ ਸਾਡਾ ਵੈਬਸਾਈਟ 'ਤੇ ਨੰਬਰ ਤੁਹਾਨੂੰ ਮਿਲ ਜਾਵੇਗਾ ਜੀ ਉੱਥੋਂ ਤੁਸੀਂ ਸਾਨੂੰ ਕਦੇ ਵੀ ਕਾਲ ਕਰ ਸਕਦੇ ਹੋ ਜੀ ਰਾਤ ਨੂੰ ਫੁੱਲ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਗਿਆਰਾਂ ਵਜੇ ਤੱਕ ਤੁਸੀਂ ਕਦੇ ਵੀ ਕਾਲ ਕਰੋ ਤਾਂ ਅਵੇਲੇਬਲ ਰਹਾਂਗੇ ਗਿਆਰਾਂ ਰਾਤ ਨੂੰ ਗਿਆਰਾਂ ਅਤੇ ਸਵੇਰੇ ਛੇ ਵਜੇ ਤੋਂ ਹਾਂਜੀ ਸਾਰਿਆਂ ਦੀ ਏਜ ਏਟੀਨ ਪਲੱਸ ਪਲੱਸ ਅਤੇ ਨਾਲ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਵੀ ਬ ਬਣਿਆ ਹੋਇਆ ਸਾਰੇ ਉਹਨਾਂ ਦੇ ਕਾਗਜ਼ ਪੂਰੇ ਨੇ ਅਤੇ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈਗਾ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ